ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਿਮਾਰੀਆਂ ਦਾ ਵਧਣ ਦਾ ਵੱਡਾ ਕਾਰਨ ਪ੍ਰਦੂਸ਼ਣ ਹੈ ਸਾਡਾ ਆਲਾ ਦੁਆਲਾ ਜਿੰਨਾਂ ਪ੍ਰਦੂਸ਼ਿਤ ਹੋਵੇਗਾ ਉੱਨੀਆਂ ਬਿਮਾਰੀਆਂ ਵਧਣਗੀਆਂ ਕਈ ਬਿਮਾਰੀਆਂ ਬਿਮਾਰੀ ਬਿਮਾਰੀ ਨੂੰ ਪੈਦਾ ਕਰਦੀ ਹੈ ਜਾਂ ਮੰਨ ਲਓ ਇੱਕ ਘਰ ਵਿੱਚ ਬਿਮਾਰੀ ਆਉਂਦੀ ਹੈ ਅਤੇ ਯਕੀਨਨ ਉਸ ਬਿਮਾਰੀ ਦਾ ਅੱਗੇ ਅਗਲੇ ਬੰਦੇ ਤੱਕ ਪਹੁੰਚਣਾ ਵੀ ਯਕੀਨਨ ਹੋ ਜਾਂਦਾ ਹੈ ਦੂਜਾ ਜਿੰਨਾਂ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਉੱਨੀਆਂ ਬਿਮਾਰੀਆਂ ਵੱਧ ਹੋ ਜਾਣੀਆਂ ਜਿਵੇਂ ਦਰੱਖਤਾਂ ਦੀ ਕਟਾਈ ਜਾਂ ਬਨੌਟੀ ਬਾਰਿਸ਼ ਜਾਂ ਬਨੌਟੀ ਹੋਰ ਕਈ ਚੀਜ਼ਾਂ ਅਸੀਂ ਸਾਡਾ ਖਾਣ ਪੀਣ ਵੀ ਇਸ ਵਿੱਚ ਮਾਇਨੇ ਅਖਵਾਉਂਦਾ ਏ ਖਾਣ ਪੀਣ ਨਾਲ ਬਿਮਾਰੀਆਂ ਅਤੇ ਇਹਨਾਂ ਤੋਂ ਬਚਣ ਲਈ ਸਭ ਤੋਂ ਵੱਡੀ ਗੱਲ ਏ ਤਾਂ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾਵੇ ਦੂਜਾ ਜਿੰਨਾਂ ਹੋ ਸਕੇ ਉੱਨਾਂ ਬਨੌਟੀ ਖਾਣੇ ਬਾਹਰ ਖਾਣੇ ਜਿਨ ਪਰਹੇਜ਼ ਕੀਤਾ ਵੇ ਘਰ ਵਿੱਚ ਤਿਆਰ ਖਾਣੇ ਨੂੰ ਭੋਜਨ ਨੂੰ ਖਾਧਾ ਜਾਵੇ ਅਤੇ ਵੱਧ ਤੋਂ ਵੱਧ ਆਲੇ ਦੁਆਲੇ ਸਫਾਈ ਰੱਖੀ ਜਾਵੇ